ਅਸੀਂ ਆਪਣੀ ਵੋਕਲ ਥਕਾਵਟ ਨੂੰ ਸੰਭਾਲਣ ਲਈ ਕਈ ਤਰ੍ਹਾਂ ਦੀ ਤਕਨੀਕਾਂ ਦੀ ਵਰਤੋਂ ਕਰਦੇ ਹਾਂ ਸਾਡੀ ਵੋਕਲ ਥਕਾਵਟ ਦੇ ਕਈ ਕਾਰਕ ਹੁੰਦੇ ਹਨ ਜਿਵੇਂ ਕਿ ਅਸੀਂ ਕਿਸੇ ਨਾਲ ਬਹੁਤ ਜੋਰ ਜੋਰ ਕੇ ਬੋਲਦੇ ਹਾਂ ਅਤੇ ਬਿਨਾਂ ਰੁਕੇ ਹੀ ਬੋਲਦੇ ਰਹਿੰਦੇ ਹਾਂ ਜਿਸ ਨਾਲ ਸਾਡੀ ਵੋਕਲ ਥੱਕ ਜਾਂਦੀ ਹੈ ਇਸ ਨੂੰ ਸ ਠੀਕ ਕਰਨ ਲਈ ਅਸੀਂ ਕਈ ਤਰ੍ਹਾਂ ਦੀ ਤਕਨੀਕਾਂ ਦੀ ਵਰਤੋਂ ਕਰਦੇ ਹਾਂ ਜਿਵੇਂ ਕਿ ਅਸੀਂ ਕਿਸੇ ਨਾਲ ਗੱਲਬਾਤ ਘੱਟ ਕਰਦੇ ਹਾਂ ਆਪਣੀ ਗਲੇ ਨੂੰ ਪੂਰਾ ਆਰਾਮ ਦੇਣ ਲਈ ਅਸੀਂ ਥੋੜ੍ਹੀ ਦੇਰ ਲਈ ਸੋ ਜਾਦੇ ਹਾਂ ਤਾਂ ਕਿ ਸਾਡੀ ਵੋਕਲ ਥਕਾਵਟ ਥੋੜ੍ਹੀ ਘੱਟ ਹੋ ਸਕੇ ਅਤੇ ਸਾਡੇ ਗਲੇ ਨੂੰ ਆਰਾਮ ਮਿਲ ਸਕੇ ਅਸੀਂ ਵੋਕਲ ਥਕਾਵਟ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੀ ਅਤੇ ਵੀ ਮਸਾਜ ਕਰਦੇ ਹਾਂ ਜਿਸ ਨਾਲ ਸਾਡੇ ਗਲੇ ਦੀ ਥਕਾਵਟ ਵਿੱਚ ਆਰਾਮ ਮਿਲਦਾ ਹੈ ਅਸੀਂ ਆਪਣੀ ਵੋਕਲ ਥਕਾਵਟ ਨੂੰ ਦੂਰ ਕਰਨ ਲਈ ਪਾ ਗਰਮ ਪਾਣੀ ਦੀ ਗਰਾਰੇ ਕਰਦੇ ਹਾਂ ਤਾਂ ਕਿ ਸਾਡੇ ਵੋਕਲ ਥਕਾਵਟ ਨੂੰ ਘੱਟ ਕੀਤਾ ਜਾ ਸਕੇ ਅਤੇ ਉਸ ਵਿੱਚ ਕਈ ਲੋ ਉ ਉਸ ਪਾਣੀ ਵਿੱਚ ਅਸੀਂ ਲੂਣ ਵੀ ਪਾਉਂਦੇ ਹਾਂ ਅਤੇ ਉਸਦੇ ਗਰਾਰੇ ਕਰਦੇ ਹਾਂ ਅਸੀਂ ਆਪਣੀ ਆਵਾਜ਼ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਨਿਯਮਾਂ ਦੀ ਵਰਤੋਂ ਕਰਦੇ ਹਾਂ ਇਸ ਵਿੱਚ ਸਭ ਤੋਂ ਪਹਿਲਾਂ ਅਸੀਂ ਬਾਹਰ ਦੀ ਖਾਣੇ ਦੀ ਵਰਤੋਂ ਘੱਟ ਕਰਦੇ ਹਾਂ ਅਤੇ ਘਰ ਦੇ ਖਾਣੇ ਨੂੰ ਜ਼ਿਆਦਾ ਮਹੱਤਵ ਦਿੰਦੇ ਹਾਂ ਕਿਉਂਕਿ ਬਾਹਰ ਦੇ ਖਾਣੇ ਵਿੱਚ ਕਈ ਤਰ੍ਹਾਂ ਦੇ ਮਿਰਚ ਮਸਾਲਿਆਂ ਦੀ ਵਰਤੋਂ ਕੀਤੀ ਹੁੰਦੀ ਹੈ ਜੋ ਕਿ ਸਾਡੀ ਗਲੇ ਦੀ ਆਵਾਜ਼ ਵਿੱਚ ਕਈ ਤਰ੍ਹਾਂ ਦੀ ਬਿਮਾਰੀਆਂ ਨੂੰ ਪੈਦਾ ਕਰਦੇ ਹਨ ਜਿਵੇਂ ਕਿ ਉਸ ਵਿੱਚ ਕਈ ਤਰ੍ਹਾਂ ਦੀਆਂ ਤਿੱਖੀਆਂ ਮਿਰਚਾਂ ਹੁੰਦੀਆਂ ਹਨ ਜੋ ਕਿ ਸਾਡੇ ਗਲੇ ਵਿੱਚ ਇਨਫੈਕਸ਼ਨ ਪੈਦਾ ਕਰਦੀਆਂ ਹਨ ਅਸੀਂ ਆਪਣੇ ਗਲੇ ਦੀ ਆਵਾਜ਼ ਨੂੰ ਠੀਕ ਰੱਖਣ ਲਈ ਬਾਹਰ ਦਾ ਕੋਲ ਡਰਿੰਕ ਵਗੈਰਾ ਵੀ ਘੱਟ ਕਰਦੇ ਹਾਂ ਕਿਉਂਕਿ ਜ਼ਿਆਦਾ ਠੰਡਾ ਚੀਜ਼ਾਂ ਦੀ ਵਰਤੋਂ ਨਾਲ ਸਾਡੇ ਗਲੇ ਦੀ ਆਵਾਜ਼ ਬੈਠ ਜਾਂਦੀ ਹੈ ਜਿਸ ਨਾਲ ਸਾਨੂੰ ਬੋਲਣ ਵੀ ਪਰੇਸ਼ਾਨੀ ਹੁੰਦੀ ਹੈ ਅਸੀਂ ਆਪਣੇ ਗਲੇ ਦੀ ਆਵਾਜ਼ ਨੂੰ ਸੁਰੱਖਿਅਤ ਰੱਖਣ ਲਈ ਰੋਜ਼ ਗਰਮ ਪਾਣੀ ਦੇ ਗਰਾਰੇ ਕਰਦੇ ਹਾਂ ਤਾਂ ਕਿ ਸਾਡੀ ਆਵਾਜ਼ ਪੂਰੀ ਤਰ੍ਹਾਂ ਸੁਰੱਖਿਅਤ ਰਹੇ ਅਤੇ ਇਸ ਵਿੱਚ ਸਾਨੂੰ ਬੋਲਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਅਸੀਂ ਆਪਣੀ ਆਵਾਜ਼ ਨੂੰ ਸੁਰੱਖਿਅਤ ਰੱਖਣ ਲਈ ਗਰਮ ਚਾਹ ਜਾਂ ਜਾਂ ਕੌਫੀ ਦੀ ਵੀ ਵਰਤੋਂ ਕਰਦੇ ਹਾਂ ਜਿਸ ਵਿੱਚ ਅਸੀਂ ਅਦਰਕ ਅਤੇ ਅਦਰਕ ਲੋਂਗ ਇਲਾਇਚੀ ਦੀ ਵਰਤੋਂ ਕਰਦੇ ਹਾਂ ਤਾਂ ਕਿ ਸਾਨੂੰ ਕਦੇ ਵੀ ਕੋਈ ਜੁਖਾਮ ਜਾਂ ਖਾਂਸੀ ਨਾ ਹੋਵੇ ਅਤੇ ਅਸੀਂ ਪੂਰੀ ਤਰ੍ਹਾਂ ਆਪਣੇ ਗਲੇ ਨੂੰ ਸੁਰਖਿਅਤ ਰੱਖ ਸਕੀਏ